ਜੀ ਹਾਂ ਬਿਲਕੁਲ ਮੈਂ ਆਪਣੇ ਨਜ਼ਰਾਂ ਤੋਂ ਇਹ ਦੇਖਿਆ ਹੈ ਕਿਉਂਕਿ ਮੈਂ ਭਾਰਤ 'ਚ ਪੈਦਾ ਹੋਈ ਹਾਂ ਅਤੇ ਸਾਡੇ ਭਾਰਤ ਵਿੱਚ ਬੱਚੇ ਬੱਚੇ ਨੂੰ ਇਸ ਬਾਰੇ ਪਤਾ ਗ੍ਰਹਿਣਾਂ ਤੋਂ ਹਰ ਕੋਈ ਵਿਆ ਬੰਦਾ ਛੋਟਾ ਬੱਚਾ ਵੱਡਾ ਬਜ਼ੁਰਗ ਸਭ ਨੂੰ ਗ੍ਰਹਿਣਾਂ ਦੇ ਬਾਰੇ ਪਤਾ ਹੈ ਗ੍ਰਹਿਣ ਵਿੱਚ ਇੱਦਾਂ ਹੁੰਦਾ ਹੈ ਕਿ ਸਾਡੇ ਇੱਥੇ ਇਹ ਮੰਨਿਆ ਜਾਂਦਾ ਵੈ ਕਿ ਜਦੋਂ ਗ੍ਰਹਿਣ ਲੱਗਦਾ ਹੈ ਇੱਕ ਸੂਰਯ ਗ੍ਰਹਿਣ ਜਾਂ ਚੰਦਰ ਗ੍ਰਹਿਣ ਤਾਂ ਅਸੀਂ ਉਹ ਗ੍ਰਹਿਣ ਵਿੱਚ ਕਿ ਮੰਦਰ ਬੰਦ ਕਰ ਦਈਦੇ ਆ ਮੰਦਿਰ ਦੇ ਕਪਾਟ ਬੰਦ ਕਰ ਦਈ ਦੇ ਹੈ ਅਸੀਂ ਕੋਈ ਪੂਜਾ ਪਾਠ ਨਹੀਂ ਕਰੀਦੀ ਉਸ ਟਾਈਮ 'ਤੇ ਅਤੇ ਜਿਹੜੀ ਗਰਭਵਤੀ ਮਹਿਲਾਵਾਂ ਹੁੰਦੀਆਂ ਉਹਨਾਂ ਨੂੰ ਸਾਡੇ ਵੱਡੇ ਵਡੇਰੇ ਇਹ ਸਲਾਹ ਦਿੰਦੇ ਹੈ ਕਿ ਉਹਨਾਂ ਨੇ ਨਾ ਤਾਂ ਸੋਨਾ ਹੁੰਦਾ ਹੈ ਨਾ ਉਹਨਾਂ ਨੂੰ ਚਾਕੂ ਦੀ ਕੋਈ ਚੀਜ਼ ਉਹਨਾਂ ਦੇ ਹੱਥੋਂ ਵਡਾਈ ਜਾਂਦੀ ਹੈ ਨਾ ਉਨ੍ਹਾਂ ਕੋਲ ਕੁਛ ਕਰਾਈ ਜਾਂਦਾ ਹੈ ਨਾ ਹੀ ਉਹਨਾਂ ਕੋਲ ਕੋਈ ਟਾਈਟ ਕੱਪੜੇ ਉਹਨਾਂ ਨੂੰ ਪਾਉਣ ਦੀ ਸਲਾਹ ਦਿੱਤੀ ਜਾਂਦੀ ਉਹਨਾਂ ਨੂੰ ਖੁੱਲ੍ਹੇ ਖੁੱਲ੍ਹੇ ਕਿਉਂਕਿ ਇਹ ਮੰਨਿਆ ਜਾਂਦਾ ਸਾਡੇ ਇੱਥੇ ਕਿ ਜੇ ਉਹ ਇਹ ਕੁਛ ਕਰਦੀਆਂ ਨੇ ਅਤੇ ਉਹਦਾ ਸਿੱਧਾ ਪ੍ਰਭਾਵ ਉਹਨਾਂ ਦੇ ਬੱਚੇ 'ਤੇ ਪੈਂਦਾ ਅਤੇ ਜਿਹੜੇ ਲੋਕ ਅ ਅਜਿਹਾ ਨਹੀਂ ਵੀ ਮੰਨਦੇ ਮੈਂ ਆਪਣੇ ਵੱਡੇ ਵਡੇਰਿਆਂ ਕੋ ਹੀ ਸੁਣਿਆ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਪ੍ਰਭਾਵ ਪੈਂਦਾ ਜਿਵੇਂ ਕਿ ਜੇ ਮੰਨ ਲਓ ਕਿਸੇ ਗਰਭਵਤੀ ਮਹਿਲਾ ਨੇ ਕੋਈ ਆਪਣਾ ਚਾਕੂ ਨਾਲ ਕੁਛ ਘੱਟ ਲਿਆ ਅਤੇ ਮੈਂ ਆਪਣੇ ਮੂੰਹੋਂ ਸੁਣੀ ਇਹ ਚੀਜ਼ ਕਿ ਉਹਨਾਂ ਦੇ ਬੱਚੇ 'ਤੇ ਕੋਈ ਨਾ ਕੋਈ ਅੰਗ ਘੱਟ ਜਾਂਦਾ ਵੈ ਜੋ ਕਿ ਇੱਕ ਨਹੀਂ ਮੈਂ ਸਮਝ ਸਕਦੀ ਪਰ ਜੋ ਅਸੀਂ ਸੁਣਿਆ ਮੈਂ ਉਹੀ ਦੱਸ ਰਹੀ ਹਾਂ ਅਤੇ ਜਿੱਦਾਂ ਹੀ ਗ੍ਰਹਿਣ ਖਤਮ ਹੁੰਦਾ ਹੈ ਅਤੇ ਗਲੀ ਗਲੀ 'ਚ ਲੋਕ ਮੰਗਣ ਵਾਲੇ ਆ ਜਾਂਦੇ ਹੈ ਅਤੇ ਲੋਕ ਦਾਨ ਪੁੰਨ ਕਰਦੇ ਆ ਨਹਾਉਂਦੇ ਹੈ ਬਸ